ਹੈਲੋ ਹਾਂਜੀ ਸਰ ਨਮਸਕਾਰ ਜੀ ਸਰ ਐਕਚੁਲੀ ਨਾ ਅਸੀਂ ਨਾ ਬਾਹਰੋਂ ਆਏ ਸੀ ਅਤੇ ਗੁਰਦਾਸਪੁਰ ਜਿਲ੍ਹੇ 'ਚ ਰਹਿੰਦੇ ਵੇ ਹਾਂ ਅਤੇ ਅਸੀਂ ਚਾਹੁੰਦੇ ਸੀ ਬਈ ਕਿਤੇ ਨਾ ਨੀਅਰ ਏਅਰਪੋਰਟ ਸਾਨੂੰ ਦੱਸੋਗੇ ਕਿੱਥੇ ਪੈਂਦਾ ਅਤੇ ਉਸ 'ਤੇ ਕਿਦ ਕਿੱਦਾਂ ਪਹੁੰਚਣਾ ਅਸੀਂ ਨਾ ਚਾਹੁੰਦੇ ਹਾਂ ਵੀ ਇੱਥੇ ਏਰੀਆ ਘੁੰਮੀਏ ਅਤੇ ਸਾਨੂੰ ਏਅਰਪੋਰਟ ਦਾ ਨਹੀਂ ਅਜੇ ਤੱਕ ਪਤਾ ਨਹੀਂ ਸਰ ਉਹ ਦੇ ਠੀਕ ਹੈ ਅਤੇ ਮੈਨੂੰ ਪਤਾ ਲੱਗਿਆ ਸੀ ਵੀ ਤੁਸੀਂ ਇੱਥੋਂ ਦੇ ਲੋਕਲ ਹੋ ਅਤੇ ਤੁਹਾਨੂੰ ਕਾਲ ਕਰਕੇ ਤਾਂ ਮੈਂ ਕਿਹਾ ਚਲੋ ਪੁੱਛ ਲੈਂਦੇ ਹਾਂ ਠੀਕ ਹੈ ਜੀ ਅਤੇ ਸਰ ਇੱਥੋਂ ਕਿੰਨੀ ਦੂਰ ਆ ਹਾਂਜੀ ਹਾਂਜੀ ਹਾਂਜੀ ਪੰਜਾਹ ਸੱਠ ਕਿਲੋਮੀਟਰ ਅਤੇ ਉਹ ਬਸ ਮਿਲ ਜਾਂਦੀ ਹੋਣੀ ਆ ਕੈਬ ਵਗੈਰਾ ਮਿਲ ਜਾਂਦੀ ਇੱਥੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਸਰ ਪਤਾ ਲੱਗ ਜਾਂਦਾ ਨਾ ਏਰੀਏ ਦਾ ਸਰ ਵੈਸੇ ਟ੍ਰੇਨ ਵੀ ਜਾਂਦੀ ਹੋਣੀ ਆ ਇੱਧਰ ਨੂੰ ਓ ਉਹ ਉਹ ਟਾਈਮ ਟਾਈਮ ਦੀ ਜਾਂਦੀ ਹੋਣੀ ਆ ਨਾ ਅੱਛਾ ਸਰ ਠੀਕ ਹੈ ਸਰ ਠੀਕ ਹੈ ਹੂੰ ਠੀਕ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਓਕੇ